ਹੈਲੋ ਵਧੀਆ ਵਧੀਆ ਜੀ ਤੁਸੀਂ ਸੁਣਾਓ ਹਾਂਜੀ ਹਾਂਜੀ ਨਹੀਂ ਨਹੀਂ ਸਹੀ ਗੱਲ ਜੀ ਆਪਾਂ ਜੀ ਜੀ ਮੈ ਵੀ ਪੜ੍ਹੀ ਸੀ ਹਾਂਜੀ ਹਾਂਜੀ ਨਹੀਂ ਮੈਂ ਤਾਂ ਜੀ ਉਹ ਬੁੱਕ ਪੜ੍ਹੀ ਮੈਨੂੰ ਤਾਂ ਵਧੀਆ ਲੱਗੀ ਪਰ ਮੈਨੂੰ ਲੱਗਦਾ ਉਹਦੇ ਵਿੱਚ ਥੋੜ੍ਹੀ ਜਿਹੀ ਚੀਜ਼ਾਂ ਕਰ ਬੈਠੀ ਸੀ ਉਹ ਮੈਨੂੰ ਵੈਸੇ ਉਹ ਬੁੱਕ ਕਾਫੀ ਚੰਗੇ ਲੱਗੀ ਉਹਨਾਂ ਨੇ ਉਹਨਾਂ ਦੇ ਰਾਈਟਿੰਗ ਸਕਿੱਲਸ ਉਹਨਾਂ ਨੇ ਜਿਸ ਤਰੀਕੇ ਨਾਲ ਕੋਵਿਡ ਬਾਰੇ ਦੱਸਿਆ ਉਹ ਇੱਕ ਤਰ੍ਹਾਂ ਨਾਲ ਮੇਰੀ ਫੇਵਰੇਟ ਤਾਂ ਬਣ ਚੁੱਕੀ ਉਹ ਬੁੱਕ ਕਿਉਂਕਿ ਬਹੁਤ ਸੋਹਣੇ ਤਰੀਕੇ ਨਾਲ ਪ੍ਰਦਸ਼ਨ ਕੀਤਾ ਗਿਆ ਸੀ ਕੋਵਿਡ ਦੇ ਨੈਗੇਟਿਵ ਅਤੇ ਪੋਜੀਟਿਵ ਐਸਪੈਕਟ ਦਾ ਜੀ ਮੈਨੂੰ ਐਜ਼ ਆ ਰੀਡਰ ਜੀ ਮੈਨੂੰ ਵੀ ਆਹੀ ਲੱਗਿਆ ਸੀ ਕਿ ਸਕਿਪ ਤਾਂ ਕੀਤੀਆਂ ਨੇ ਜਿਵੇਂ ਲੋਕਾਂ ਦੇ ਨਾਲ ਬਹੁਤ ਬੁਰਾ ਵੀ ਹੋ ਗਿਆ ਸੀ ਵਿੱਚੋਂ ਨਹੀਂ ਨਹੀਂ ਹਾਂਜੀ ਜੀ ਬਹੁਤ ਸਹੀ ਗੱਲ ਕਹੀ ਤੁਸੀਂ ਇਮੋਸ਼ਨਲ ਨੀਡਸ ਵਗੈਰਾ ਵੀ ਸਕਿਪ ਹੋ ਗਈ ਕਿ ਲੋਕਾਂ ਦਾ ਜਿਵੇਂ ਘਾਟਾ ਪੈ ਗਿਆ ਉਸ ਤੋਂ ਬਾਅਦ ਜਿਨਾਂ ਦੇ ਫੈਮਲੀ ਮੈਂਬਰ ਦੀ ਡੈੱਥ ਹੋ ਗਈ ਉਹਨਾਂ ਨਾਲ ਉਹਨਾਂ ਉੱਤੇ ਕੀ ਬੀਤੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਹੀ ਗੱਲ ਹੈ ਅਸਲ 'ਚ ਬੁੱਕ 'ਚ ਉਹਨਾਂ ਨੇ ਦਰਸਾਇਆ ਤਾਂ ਬੜੇ ਚੰਗੇ ਤਰੀਕੇ ਨਾਲ ਹੈ ਜੋ ਜਿੰਨਾਂ ਕੁ ਵੀ ਦਰਸਾਇਆ ਓਨਾ ਹੀ ਚੰਗਾ ਦਰਸਾਇਆ ਪਰ ਕਈ ਚੀਜ਼ਾਂ ਛੱਡ ਵੀ ਦਿੱਤੀਆਂ ਹੁਣ ਭਾਵੇਂ ਉਹਨਾਂ ਨੇ ਨੇਚਰ ਬਾਰੇ ਦਰਸਾਇਆ ਕਿ ਨੇਚਰ ਨੇ ਆਪਦੇ ਆਪ ਨੂੰ ਸਹੀ ਕਰ ਲਿਆ ਕਿਉਂਕਿ ਲੋਕ ਤਾਂ ਲੱਗੇ ਹੀ ਰਹੇ ਸੀ ਪੂਰਾ ਉਹਨੂੰ ਖਰਾਬ ਕਰਨ ਵਾਸਤੇ ਹਮ ਹਾਂਜੀ ਹਾਂਜੀ ਜੀ ਠੀਕ ਹੈ